ਸਤਿ ਸ਼੍ਰੀ ਅਕਾਲ ਭਾਅ ਜੀ ਜਗਜੀਤ ਭਾਅ ਜੀ ਬੋਲਦੇ ਸਰ ਸਰ ਮੈਂ ਕਰਮਵੀਰ ਬੋਲਣ ਡਿਆ ਵਾਂ ਬਟਾਲ ਗੁਰਦਾਸਪੁਰ ਤੋਂ ਅਤੇ ਮੈਂ ਆਖਣ ਡਿਆ ਵੀ ਮੈਂ ਨਾ ਇੱਥੇ ਨਵਾਂ ਨਵਾਂ ਸ਼ਿਫਟ ਹੋਇਆ ਵਾਂ ਅਤੇ ਇੱਥੇ ਨਾ ਸਬਜ਼ੀਆਂ ਬਾਰੇ ਕੋਈ ਫਰੈਸ਼ ਸਬਜ਼ੀਆਂ ਕਿਤੇ ਇੱਥੋਂ ਮਿਲ ਜਾਂਦੀਆਂ ਵਾ ਖਾਣ ਵਾਸਤੇ ਹੈ ਕੋਈ ਅੱਛਾ ਅੱਛਾ ਠੀਕ ਆ

ਅੱਛਾ ਜਿਹੜੀ ਜ਼ਿਆਦਾ ਫਰੈਸ਼ ਲਿਆਉਂਦੇ ਕਈ ਕਹਿੰਦੇ ਕਿ ਨਾ ਜਿੰਮੀਦਾਰਾਂ ਕੋਲ ਜ਼ਿਆਦਾ ਫਰੈਸ਼ ਮਿਲ ਜਾਂਦੀ ਉਹ ਕਿੱਥੋਂ ਮਿਲਦੀ

ਹਾਂਜੀ ਅੱਛਾ ਅੱਛਾ ਠੀਕ ਆ ਤੇ ਰੇਟ ਰੂਟ ਜਾਇਜ਼ ਹੁੰਦਾ ਉੱਥੇ ਅੱਛਾ ਠੀਕ ਆ ਉਹ ਆਪਣਾ ਮਾਰਜਨ ਰੱਖ ਕੇ ਫਿਰ ਵੇਚਦੇ ਹੋਣੇ ਠੀਕ ਆ ਆਹੋ ਇਹ ਨਾ ਫਿਰ ਨਵੇਂ ਨਵੇਂ ਸ਼ਿਫਟ ਹੋਏ ਅਤੇ ਸਾਨੂੰ ਇੱਥੋਂ ਦੀ ਮਾਰਕੀਟਾਂ ਬਾਰੇ ਅਜੇ ਨਹੀਂ ਪੂਰਾ ਪਤਾ ਅੱਛਾ ਠੀਕ ਹੈ ਠੀਕ ਹੈ ਚਲੋ ਬੱਚਿਆਂ ਬੁੱਚਿਆਂ ਨੇ ਖਾਣੀ ਨੀ ਤੁਹਾਨੂੰ ਪਤਾ ਫਿਰ ਚੀਜ਼ ਫਰੈਸ਼ ਹੋਵੇ ਤੇ ਫਿਰ ਤਾਂ ਵਧੀਆ ਚਲੋ ਬਹੁਤ ਬਹੁਤ ਤੁਹਾਡਾ ਫਿਰ ਧੰਨਵਾਦ ਭਾਅ ਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਹੈਂ ਹਾਂ ਠੀਕ ਆ ਅ ਓ ਓ ਓਕੇ ਸਾਹਬ ਜੀ ਓਕੇ ਮਿਹਰਬਾਨੀ